ਖੇਡਾਂ ਬੈਟ ਬੋਲ ਇੱਕ ਬਹੁਤ ਅੱਛੀ ਖੇਡ ਹੈਗੀ ਆ ਉਹਦੇ ਵਿੱਚ ਗਿਆਰਾਂ ਪਲੇਅਰ ਹੁੰਦੇ ਹੈ ਇੱਕ ਬੈਟ ਹੁੰਦਾ ਹੈ ਬੋਲ ਹੁੰਦੀ ਹੈ ਔਰ ਉਹਨੂੰ ਗਿਆਰਾਂ ਪਲੇਅਰ ਖੇਡਦੇ ਆ ਇੱਕ ਬੈਟ ਬੈਟਿੰਗ ਕਰਦਾ ਔਰ ਇੱਕ ਬੋਲਿੰਗ ਕਰਦਾ ਜੋ ਬੋਲਿੰਗ ਕਰਦਾ ਉਹ ਜਦੋਂ ਬੋਲ ਕਰਦਾ ਹੈ ਔਰ ਜੋ ਬੈਟਮੈਨ ਹੁੰਦਾ ਉਹ ਬੈਟ ਮਾਰਦਾ ਅਤੇ ਅਗਰ ਵਿਕਟ 'ਤੇ ਬੋਲ ਲੱਗ ਜਾਵੇ ਤਾਂ ਆਊਟ ਹੋ ਜਾਂਦਾ ਇਨਸਾਨ ਇਹ ਸਾਡੀ ਬੈਟ ਬੋਲ ਦੀ ਗੱਲ ਹੋ ਗਈ ਆ ਔਰ ਫਿਰ ਇੱਕ ਖੇਡ ਹੁੰਦੀ ਹੈ ਕਬੱਡੀ ਕਬੱਡੀ ਵਿੱਚ ਦੋ ਪਲੇਅਰ ਦੋ ਟੀਮਾਂ ਹੁੰਦੀਆਂ ਦੋ ਟੀਮਾਂ ਹੁੰਦੀਆਂ ਇੱਕ ਟੀਮ ਦੂਸਰੀ ਟੀਮ ਨਾਲ ਮੁਕਾਬਲਾ ਕਰਦੀ ਹੈ ਉਹ ਦੂਸਰੀ ਟੀਮ ਨੂੰ ਹਰਾਨ ਦੀ ਕੋਸ਼ਿਸ਼ ਕਰਦੀ ਹੈ ਜਿਸ ਤਰ੍ਹਾਂ ਹੀ ਖੇਡਦੇ ਖੇਡਦੇ ਉੱਧਰ ਨੂੰ ਆਉਂਦੇ ਆ ਦੂਸਰੀ ਟੀਮ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਕਿ ਅਸੀਂ ਉਹਨੂੰ ਉਹਦੀ ਲਾਈਨ ਦੇ ਪਾਰ ਨਾ ਜਾਣ ਦਿੱਤਾ ਜਾਵੇ ਅਤੇ ਅਸੀਂ ਉਹਨੂੰ ਫੜ ਲਈਏ ਔਰ ਅਸੀਂ ਜਿੱਤ ਜਾਈਏ ਇਸ ਤਰ੍ਹਾਂ ਹੀ ਇਹ ਖੇਡ ਕਬੱਡੀ ਖੇਡੀ ਜਾਂਦੀ ਹੈ ਔਰ ਖੇਡਿਆ ਜਾਂਦਾ ਹੈ ਬੈਡਮਿੰਟਨ ਬੈਡਮਿੰਟਨ 'ਚ ਦੋ ਪਲੇਅਰ ਹੁੰਦੇ ਹੈ ਰੈਕਿਟ ਹੁੰਦੇ ਆ ਦੋ ਔਰ ਇੱਕ ਸ਼ਟਲ ਹੁੰਦੀ ਹੈ ਉਹ ਦੋ ਜਣੇ ਉਹਨੂੰ ਖੇਡਦੇ ਆ ਇੰਜੋਆਏ ਕਰਨ ਲਈ ਖੇਡਆ ਜਾਂਦਾ ਹੈਗਾ ਔਰ ਕਬੱਡੀ ਹੁੰਦੀ ਹੈ ਕੁੜੀਆਂ ਨੂੰ ਕੱਬ ਕੁੜੀਆਂ ਨੂੰ ਔਰ ਖੋ ਖੋ ਹੁੰਦੀ ਹੈ ਔਰ ਕੁੜੀਆਂ ਨੂੰ ਖੋ ਖੋ ਖੇਡਣਾ ਬਹੁਤ ਪਸੰਦ ਹੈਗਾ ਖੋ ਖੋ ਦੇ ਵਿੱਚ ਕੁੜੀਆਂ ਲਾਈਨ ਬਣਾ ਕੇ ਬੈਠਦੀਆਂ ਇਹ ਇੱਕ ਦੂਸਰੇ ਦੇ ਅਪੋਜਿਟ ਬੈਠਦੀਆਂ ਇੱਕ ਦੂਸਰੇ ਦੇ ਅਪੋਜਿਟ ਬੈਠਦੀਆਂ ਔਰ ਇੱਕ ਦੀ ਟਰਨ ਆਉਂਦੀ ਹੈ ਤਾਂ ਉਹ ਮਤਲਬ ਕਿ ਪੂਰੇ ਚੱਕਰ ਲਗਾਉਂਦੀ ਆ ਉਹ ਜਿਹਨੂੰ ਖੋ ਕਰਕੇ ਮਤਲਬ ਕਿ ਪਿੱਠ 'ਤੇ ਹੱਥ ਮਾਰ ਦੇਵੇਗੀ ਜਿਹਦੀ ਖੋ ਕਰਕੇ ਹੱਥ ਮਾਰੀ ਹੈ ਉਹਦੀ ਟਰਨ ਆ ਜਾਂਦੀ ਹੈ ਉਹ ਉਹਦੀ ਜਗ੍ਹਾ 'ਤੇ ਬਹਿ ਜਾਂਦੀ ਹੈ ਉਹ ਫਿਰ ਉੱਠ ਕੇ ਦੁਬਾਰਾ ਉਹ ਕੁੜੀ ਖੇਡਦੀ ਹੈ